ਮੈਂ ਆਪਣੀ ਤਾਕਤ ਅਤੇ ਲਚਕਤਾ ਸਿਖਲਾਈ ਨੂੰ ਆਪਣੇ ਰੋਜ਼ਾਨਾ ਦੀ ਰੂਟੀਨ ਵਿੱਚ ਇਸ ਪ੍ਰਕਾਰ ਕਰਦੀ ਹਾਂ ਜਿਵੇਂ ਤਾਕਤ ਸਿਖਲਾਈ ਵਿਸ਼ੇਸ਼ ਵਰਕ ਆਊਟ ਵਜਨ ਉਠਾਉਣਾ ਬਾਡੀ ਵਾਈਡ ਐਕਸਰਸਾਈਜ਼ਜ਼ ਜਿਵੇਂ ਪੁਸ਼ਪ ਸਕੂਐਂਟ ਜਾਂ ਰੂਪ ਬੰਦੂਕ ਵਰਗੀਆਂ ਐਕਸਰਸਾਈਜ਼ਿਜ਼ ਆਪਣੀ ਤਾਕਤ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀਆਂ ਹਨ ਸਪਲੀਮੈਂਟਰੀ ਐਕਸਰਸਾਈਜ਼ਿਜ਼ ਇਹ ਸ਼ਾਮਿਲ ਕਰ ਸਕਦੇ ਹਨ ਡੈਡਲਿਫ ਬੈਚਪ੍ਰੈਸ ਅਤੇ ਲਿਫਟਿੰਗ ਮਸ਼ੀਨ ਮਹਿੰਗਾ ਰੂਟੀਨ ਹਫਤੇ ਵਿੱਚ ਦੋ ਦਫਾ ਜਾਂ ਤਿੰਨ ਤੀਹ ਪੰਤਾਲੀ ਮਿੰਟ ਦੀ ਸਿਖਲਾਈ ਵਿਸ਼ੇਸ਼ ਕਰਕੇ ਵੱਖ ਵੱਖ ਪੇਸ਼ੀ ਦੇ ਗਰੁੱਪਾਂ ਨੂੰ ਨਿਸ਼ਾਨਾ ਬਣਾਉਣਾ ਲਚਕਤਾ ਸਿਖਲਾਈ ਖਿੱਚਣ ਦੇ ਅਭਿਆਸ ਸੈਟਿੰਗ ਵਿੱਚ ਸਧਾਰਨ ਖਿੱਚਣ ਜਿਵੇਂ ਹਸ ਲਿਫਟ ਕਿਪ ਟਰੈਲ ਅਤੇ ਐਟ ਕੱਟਨ ਜਾਂ ਗਲੂਟ ਖਿੱਚਣ ਦੀ ਵਰਤੋਂ ਕਰੋ ਯੋਗਾ ਜਾਂ ਪਾਈਲ ਆਰਟਸ ਇਹ ਦੋਹਾਂ ਦੀ ਵਿਧਾਵਾਂ ਲਚਕਤਾ ਨੂੰ ਵਧਾਉਂਦੀਆਂ ਹਨ ਅਤੇ ਸਰੀਰ ਨੂੰ ਕੁਝ ਨਵੀਂ ਹਿਫਾਜ਼ਤ ਦੇ ਅਹਿਸਾਸ ਕਰਵਾਉਂਦੀਆਂ ਹਨ ਹਫਤੇ ਵਿੱਚ ਦੋ ਤਿੰਨ ਦਫੇ ਲਚਕਤਾ ਦੀ ਸਿਖਲਾਈ ਵੀਹ ਤੀਹ ਮਿੰਟ ਦੇ ਦੌਰਾਨ ਕਰੋ ਜਿਸ ਵਿੱਚ ਵੱਖਰੇ ਖਿੱਚਣ ਦੇ ਅਭਿਆਸ ਸ਼ਾਮਿਲ ਕਰੋ ਖਿੱਚਣ ਦੀ ਰੂਟੀਨ ਲੰਬਾਈ ਦਸ ਪੰਦਰਾਂ ਮਿੰਟ ਦੀ ਖਿੱਚਣ ਦੀ ਰੂਟੀਨ ਹਰ ਦਿਨ ਜਾਂ ਵਰਕਆਊਟ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਰਨ ਦੀ ਕੋਸ਼ਿਸ਼ ਕਰੋ ਸ਼ਾਮਿਲ ਕਰੋ ਮੈਰਿਨ ਵਾਲੇ ਖਿੱਚਣ ਫਲੈਕਸੀਬਲ ਖਿੱਚਣ ਅਤੇ ਗਤੀਸ਼ੀਲ ਖਿੱਚਣ ਲਾਭ ਵਧੀਕ ਤਾਕਤ ਸਰੀਰ ਦੀ ਮਾਸ਼ਪੇਸ਼ੀ ਦੀ ਤਾਕਤ ਵਿੱਚ ਵਾਧਾ ਹੋਵੇਗਾ ਜੋ ਦਿਨ ਬ ਦਿਨ ਦੀਆਂ ਕਿਰਤਾਂ ਲਈ ਮਦਦਗਾਰ ਹੈ ਲਚਕਤਾ ਵਿੱਚ ਸੁਧਾਰ ਇਹ ਮੂਵਮੈਂਟ ਦੀ ਰੇਂਜ ਨੂੰ ਵਧਾਉਂਦਾ ਹੈ ਜਿਸ ਨਾਲ ਸਰੀਰ ਨੂੰ ਚੁਸਤ ਬਣਾਉਂਦਾ ਹੈ ਜਿਣਸੀ ਨੁਕਸਾਨ ਘਟਾਉਣਾ ਸਹੀ ਖਿੱਚਣ ਅਤੇ ਤਾਕਤ ਸਿਖਲਾਈ ਲਈ ਚੋਟਾਂ ਦਾ ਖਤਰਾ ਘਟਦਾ ਹੈ